ਪੰਜਾਬ ਦੀਆਂ ਪ੍ਰਮੁੱਖ ਧਾਰਮਿਕ ਪਰੰਪਰਾਵਾਂ ਵਿੱਚ ਜੀ ਗੁਰੂ ਸਾਹਿਬ ਦੀ ਜਿਹੜੀ ਹਾਜ਼ਰੀ ਆ ਉਹ ਬੜੀ ਹੀ ਸ਼ਾਨੋ ਸ਼ੌਕਤ ਅਤੇ ਧੂਮ ਧਾਮ ਨਾਲ ਲਿਆਉਂਦੀ ਜਾਂਦੀ ਹੈ ਪੂਰੀ ਸਵਾਰ ਕੇ ਸਜ ਸਵਾਰ ਕੇ ਫੁੱਲਾਂ ਦੀ ਵਰਖਾ ਕਰਕੇ ਹਾਜ਼ਰੀ ਭਰੀ ਜਾਂਦੀ ਹੈ ਇਹ ਇਸ ਤੋਂ ਇਲਾਵਾ ਜਿਹੜਾ ਪਰੰਪਾ ਧਾਰਮਿਕ ਪਰੰਪਰਾ ਵਿੱਚ ਜਿਹੜੀ ਪ੍ਰਸ਼ਾਦਾ ਵਾ ਉਹ ਸੰਗਤ ਨੂੰ ਪੰਗਤ ਵਿੱਚ ਬਿਠਾ ਕੇ ਛਕਾਇਆ ਜਾਂਦਾ ਹੈ ਰਸਮਾਂ ਦੀ ਜੇ ਗੱਲ ਕਰੀਏ ਤਾਂ ਸਾਡੇ ਪੁਰਾਤਨ ਰਸਮਾਂ ਮੁਤਾਬਿਕ ਜਿਹੜੀ ਧੀ ਦਾ ਵਿਆਹ ਦੇ ਚੂੜੇ ਦਾ ਹੁੰਦਾ ਸੀ ਉਹ ਉਹਨਾਂ ਦੇ ਮਾਮੇ ਵੱਲੋਂ ਦਿੱਤਾ ਜਾਂਦਾ ਸੀ ਫਿਰ ਇਸ ਤੋਂ ਇਲਾਵਾ ਚੂੜਾ ਪਹਿਨਣ ਵੇਲੇ ਕੱਚੀ ਲੱਸੀ 'ਚ ਰੱਖਿਆ ਜਾਂਦਾ ਸੀ ਧੀ ਜਦੋਂ ਆਪਣਾ ਘਰ ਛੱਡ ਕੇ ਦੂਜੇ ਘਰ ਜਾਂਦੀ ਹੈ ਤਾਂ ਉਹ ਪਿੱਛੇ ਚੋਲ ਸੁੱਟ ਕੇ ਇਹ ਜਾਂਦੀ ਹੈ ਅਤੇ ਜਿਹੜੇ ਉਹਦੇ ਭਰਾ ਨੇ ਉਹ ਗੱਡੀ ਨੂੰ ਧੱਕਾ ਲਾਉਂਦੇ ਹਨ ਹੋਰ ਰਸਮਾਂ 'ਚ ਜਦੋਂ ਕਦੀ ਵੀ ਕੋਈ ਨਵੀਂ ਚੀਜ਼ ਲਿਆਉਂਦੀ ਜਾਂਦੀ ਹੈ ਅਤੇ ਘਰ ਦੇ ਬਾਹਰ ਤੇਲ ਚੋਇਆ ਜਾਂਦਾ ਹੈ ਹੋਰ ਰਸਮਾਂ ਮੁਤਾਬਿਕ